ਹੈਲੋ ਹਾਂਜੀ ਸੁਰਿੰਦਰ ਭਾਅ ਜੀ ਲਾਇਬ੍ਰੇਰੀ ਵਾਲੇ ਹਾਂਜੀ ਭਾਅ ਜੀ ਮੈਂ ਨਾ ਇੱਥੋਂ ਪ੍ਰੇਮ ਨਗਰ ਤੋਂ ਬੋਲਦਾ ਗਾ ਭਾਜੀ ਮੈਂ ਤੁਹਾਡੀ ਲਾਇਬ੍ਰੇਰੀ ਦਾ ਨਾਮ ਵੀ ਸੁਣਿਆ ਕਾਫੀ ਅਤੇ ਕਿਤਾਬਾਂ ਵੀ ਇੱਕ ਦੋ ਵਾਰ ਮੈਂ ਉੱਥੇ ਜਾ ਕੇ ਰੀਡ ਕਰਕੇ ਆਇਆ ਅਤੇ ਹਾਂਜੀ ਹਾਂਜੀ ਭਾਅ ਜੀ ਮੈਨੂੰ ਨਾ ਆਪਣੀ ਕਿਤਾਬ ਲੈਣੀ ਸੀਗੀ ਕਿ ਆਪਾਂ ਜਿੱਦਾਂ ਹੁਣ ਘਰ ਬੈਠ ਕੇ ਪੜ੍ਹ ਸਕੀਏ ਉੱਥੇ ਤਾਂ ਮੈਂ ਜਾ ਕੇ ਕਈ ਵਾਰੀ ਪੜ੍ਹੀ ਆ ਤੁਹਾਡੇ ਕੋਲ ਅਤੇ ਅੱਛਾ ਜੀ ਅਤੇ ਆਪਣਾ ਇਹਦਾ ਕਿਆ ਚਾਰਜ ਵਗੈਰਾ ਲਾਉਂਦੇ ਆ ਜੀ ਤੁਸੀਂ ਬੁੱਕ ਦਾ

ਅੱਛਾ ਜੀ ਠੀਕ ਹੈ ਜੀ ਅੱਛਾ ਜੀ

ਅੱਛਾ ਜੀ ਠੀਕ ਹੈ ਜੀ ਅੱਛਾ ਜੀ ਅੱਛਾ ਜੇ ਬਾਈ ਦਾ ਵੇਅ ਮਤਲਬ ਜਿੱਦਾਂ ਹੁਣ ਕਿਤਾਬ ਸਾਨੂੰ ਮ ਫਿੱਟ ਬੈਠ ਗਈ ਅਸੀਂ ਨਹੀਂ ਅੱਗੇ ਵਾਪਸ ਕਰਨਾ ਚਾਹੁੰਦੇ ਤੁਹਾਨੂੰ ਫਿਰ ਉਹਦੇ ਤੁਸੀਂ ਚਾਰਜ ਫੁੱਲ ਲਉਂਗੇ ਜੀ

ਅੱਛਾ ਜੀ ਮਤਲਬ ਹੋਰ ਕੋਈ ਪਰੂਫ ਤਾਂ ਨਹੀਂ ਰੱਖਦੇ ਤੁਸੀਂ ਜਿੱਦਾਂ ਆਧਾਰ ਕਾਰਡ ਜਾਂ ਕੋਈ ਹੋਰ ਚੀਜ਼ ਹੁੰਦੀ ਹੈ ਪਰੂਫ਼ ਰੱਖਣ ਵਾਸਤੇ ਅੱਛਾ ਜੀ ਅਤੇ ਲਾਇਬ੍ਰੇਰੀ ਦਾ ਟਾਈਮ ਕਿੰਨਾ ਅੱਛਾ ਅੱਛ ਠੀਕ ਹੈ